ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਸਮਾਰਟ ਫੋਨ ਨਹੀਂ ਹੁੰਦੇ ਸੀ ਸਿਰਫ ਮੋਬਾਈਲ ਫੋਨ ਜਿਹੜੇ ਹੋਂਦ ਦੇ ਵਿੱਚ ਆਏ ਸੀ ਤਾਂ ਉਸ ਟਾਈਮ ਦੇ ਉੱਪਰ ਜਿਹੜੇ ਮੋਬਾਈਲ ਹੁੰਦੇ ਸੀ ਉਹ ਬਟਨਾ ਵਾਲੇ ਮੋਬਾਈਲ ਹੁੰਦੇ ਸੀ ਜਿਹਨਾਂ ਦੇ ਵਿੱਚ ਉਹ ਜਿਹਨਾਂ ਦਾ ਸਾਈਜ਼ ਵੀ ਦੇਖਣ ਦੇ ਵਿੱਚ ਛੋਟਾ ਹੁੰਦਾ ਸੀ ਬਟਨ ਲੱਗੇ ਹੁੰਦੇ ਸੀ ਉਹਨਾਂ 'ਤੇ ਇੱਕ ਤੋਂ ਲੈ ਕੇ ਨੌ ਤੱਕ ਜ਼ੀਰੋ ਅੱਖਰ ਵੀ ਹੁੰਦਾ ਸੀ ਉਹਨਾਂ ਦੇ ਵਿੱਚ ਇਹ ਸਾਰੇ ਹੁੰਦੇ ਸੀ ਪਹਿਲਾਂ ਜਿਹੜੇ ਮੋਬਾਈਲ ਫੋਨ ਹੁੰਦੇ ਸੀ ਛੋਟੇ ਮੋਬਾਈਲ ਫੋਨ ਹੁੰਦੇ ਸੀ ਉਹਨਾਂ ਦੇ ਨਾਲੋਂ ਅੱਜ ਦੇ ਜਿਹੜੇ ਸਮਾਰਟ ਫੋਨ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈ ਤਬਦੀਲੀ ਆ ਚੁੱਕੀ ਆ ਅੱਜ ਕੱਲ੍ਹ ਦੇ ਜਿਹੜੇ ਸਮਾਰਟ ਫੋਨ ਹਨ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲੀਅਤ ਹੁੰਦੀ ਹੈ ਤੁਸੀਂ ਕੁਝ ਵੀ ਆਪਣੇ ਸਮਾਰਟ ਫੋਨ ਦੇ ਵਿੱਚ ਕਰ ਸਕਦੇ ਹੋ ਬਹੁਤ ਕਿੰਨੀ ਜ਼ਿਆਦਾ ਤੁਸੀਂ ਫੋਟੋਆਂ ਡਾਟਾ ਆਪਣੇ ਡਾਕੂਮੈਂਟ ਦਸਤਾਵੇਜ਼ ਆਪਨੇ ਸਮਾਰਟ ਫੋਨ ਦੇ ਵਿੱਚ ਹੀ ਸੇਵ ਕਰਕੇ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਤਹਾਨੂੰ ਲੋੜ ਪਵੇ ਤੁਸੀਂ ਆਪਣੇ ਫੋਨ ਦੇ ਵਿੱਚੋਂ ਹੀ ਸਾਰਾ ਕੁਝ ਕਿਸ ਕੱਢ ਕੇ ਦੇਖ ਸਕਦੇ ਹੋ ਜਾਂ ਦਿਖਾ ਸਕਦੇ ਹੋ ਪਹਿਲਾਂ ਜਿਹੜੇ ਮੋਬਾਈਲ ਫੋਨ ਹੁੰਦੇ ਸੀ ਉਹਨਾਂ ਦੇ ਵਿੱਚ ਇਹ ਸਾਰੀ ਸਹੂਲੀਅਤ ਨਹੀਂ ਹੁੰਦੀ ਸੀ ਉਹ ਸਿਰਫ ਗੱਲ ਕਰਨ ਵਾਸਤੇ ਇੱਕ ਦੂਜੇ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਗੱਲ ਕਰਨ ਵਾਸਤੇ ਯੂਜ਼ ਕੀਤੇ ਜਾਂਦੇ ਸੀ ਵਰਤੋਂ ਦੇ ਵਿੱਚ ਲਿਆਉਂਦੇ ਜਾਂਦੇ ਸੀ ਪਰ ਅੱਜ ਕੱਲ੍ਹ ਦੇ ਜਿਹੜੇ ਸਮਾਰਟ ਫੋਨ ਨੇ ਉਹਨਾਂ ਨੂੰ ਤੁਸੀਂ ਹਰ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ ਕੁਛ ਵੀ ਤੁਸੀਂ ਆਪਣੇ ਆਪ ਮੋਬਾਈਲ 'ਤੇ ਦੇਖ ਸਕਦੇ ਹੋ ਲੱਭ ਸਕਦੇ ਹੋ ਸਰਚ ਕਰ ਸਕਦੇ ਹੋ ਗੂਗਲ 'ਤੇ ਸਰਚ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਡੇ ਹੱਥ ਦੇ ਵਿੱਚ ਫੜੇ ਮੋਬਾਇਲ ਦੇ ਉੱਤੇ ਤੁਹਾਨੂੰ ਮਿਲ ਜਾਵੇਗੀ ਪਹਿਲਾਂ ਦੇ ਮੁਕਾਬਲੇ ਨੈਟਵਰਕ ਕਨੈਕਸ਼ਨ ਜਿਹੜੇ ਅੱਜ ਕੱਲ੍ਹ ਹੈ ਉਹਨਾਂ ਦੇ ਵਿੱਚ ਵੀ ਬਹੁਤ ਤਬਦੀਲੀਆਂ ਆਈਆਂ ਨੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਡਿਵੈਲਪਮੈਂਟ ਕੀਤੀ ਜਾ ਚੁੱਕੀ ਹੈ ਥਾਂ ਥਾਂ 'ਤੇ ਟਾਵਰ ਲਗਾਏ ਗਏ ਨੇ ਨੈਟਵਰਕ ਦੇ ਟਾਵਰ ਲਗਾਏ ਗਏ ਨੇ ਕੰਪਨੀਆਂ ਵੱਲੋਂ ਜਿਹਦੇ ਨਾਲ ਕਿ ਨੈਟਵਰਕ ਦੇ ਵਿੱਚ ਬਹੁਤ ਜ਼ਿਆਦਾ ਨੈਟਵਰਕ ਕਨੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਗਿਆ ਹੈ ਪਹਿਲਾਂ ਦੇ ਮੁਕਾਬਲੇ ਹੁਣ ਜਿਹੜੇ ਨੈਟਵਰਕ ਕਨੈਕਸ਼ਨ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ ਮੇਰੇ ਕੋਲ ਜੀਓ ਕੰਪਨੀ ਦਾ ਸਿਮ ਵੀ ਹੈ ਅਤੇ ਮੇਰੇ ਕੋਲ ਇਹ ਬੀ ਐਸ ਐਨ ਐਲ ਕੰਪਨੀ ਜਿਹੜੀ ਸਰਕਾਰੀ ਕੰਪਨੀ ਆ ਉਹਨਾਂ ਦਾ ਸਿਮ ਵੀ ਹੈ ਮੈਂ ਹਰ ਮਹੀਨੇ ਰਿਚਾਰਜ ਜੀਓ ਦਾ ਜਿਹੜਾ ਰਿਚਾਰਜ ਛੇ ਸੌ ਛਿਆਹਠ ਰੁਪਏ ਦਾ ਪੈਕ ਪਵਾਉਂਦੀ ਹਾਂ ਜਿਹੜਾ ਕਿ ਚੁਰਾਸੀ ਦਿਨਾਂ ਵਾਸਤੇ ਹੁੰਦਾ ਹੈ ਔਰ ਬੀ ਐਸ ਐਨ ਐਲ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਸੌ ਇਕਹੱਤਰ ਰੁਪਏ ਦਾ ਕੋਈ ਰਿਚਾਰਜ ਕਰਵਾਉਂਦੀ ਹਾਂ ਜਿਹਦੇ ਵਿੱਚ ਕਿ ਮੈਨੂੰ ਪੈਸੇ ਵੀ ਮਿਲਦੇ ਹਨ ਅਤੇ ਮੈਨੂੰ ਵੈਲੀਡਿਟੀ ਵੀ ਮਿਲਦੀ ਹੈ ਸੱਤਰ ਕੁ ਦੇ ਕਰੀਬ ਦਿਨਾਂ ਦੀ ਤਾਂ ਮੇਰੇ ਹਿਸਾਬ ਨਾਲ ਜਿਹੜਾ ਜੀਓ ਦਾ ਨੈਟਵਰਕ ਹੈ ਉਹ ਮੇਰੇ ਲਈ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਉਹਦੇ ਵਿੱਚ ਨੈਟ ਵੀ ਚੱਲਦਾ ਹੈ ਅਤੇ ਛੇ ਚੁਰਾਸੀ ਦਿਨਾਂ ਵਾਸਤੇ ਹੁੰਦਾ ਹੈ ਉਹ ਤਾਂ ਮੇਰੇ ਲਈ ਉਹ ਜ਼ਿਆਦਾ ਫਾਇਦੇਮੰਦ ਹੈ